ਲੁਧਿਆਣੇ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਮੁਖ ਸਿਹਤ ਸੰਭਾਲ ਸਹੂਲਤਾਂ ਹਨ ਜਿਵੇਂ ਕਿ ਫਰੀ ਕੈਂਪ ਲਾਏ ਜਾਂਦੇ ਹਨ ਪਾਰਕ ਬਣਾਏ ਹਨ ਜਿੱਥੇ ਸਾਨੂੰ ਸ਼ੁੱਧ ਹਵਾ ਮਿਲਦੀ ਹੈ ਅਤੇ ਸਾਨੂੰ ਇੰਨਾਂ ਵਧੀਆ ਉੱਥੇ ਐਕਸਰਸਾਈਜ਼ ਵਾਲੇ ਝੂਟੇ ਲਾਏ ਹਨ ਕਿ ਜਿੰਨਾਂ ਅਸੀਂ ਐਕਸਰਸਾਈਜ਼ ਕਰਦੇ ਹਾਂ ਸਾਡੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਬਜ਼ੁਰਗ ਵੀ ਉੱਥੇ ਆ ਕੇ ਬੈਠਦੇ ਹਨ ਥੋੜੀਆਂ ਬਹੁਤੀਆਂ ਗੱਲਾਂ ਕਰਦੇ ਹਨ ਜਿਸ ਨਾਲ ਉਹਨਾਂ ਦਾ ਨੇਚਰ ਸਾਰਾ ਕੁਝ ਸਹੀ ਹੁੰਦਾ ਆ ਅਤੇ ਹੋਸਪਿਟਲਾਂ ਦੇ ਵਿੱਚ ਜਿਵੇਂ ਕਿ ਉਹਨਾਂ ਨੇ ਕਾਫੀ ਫਰੀ ਚੈੱਕ ਅਪ ਵਗੈਰਾ ਕਰਨੇ ਸ਼ੁਰੂ ਕੀਤੇ ਹਨ ਜਿਸ ਨਾਲ ਗਰੀਬ ਲੋਕਾਂ ਦੀ ਬਹੁਤ ਮਦਦ ਹੋ ਰਹੀ ਹੈ ਅਤੇ ਫਾਰਮੈਸੀਆਂ ਦੇ ਵਿੱਚ ਕਈ ਕੈਂਪ ਲਗਾ ਰਹੇ ਹਨ ਜਿੱਥੇ ਫਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉਹ ਲੋਕਾਂ ਲਈ ਬਹੁਤ ਮਦਦ ਕਰ ਰਹੇ ਜਿਵੇਂ ਕੋਈ ਪੈਸੇ ਨਹੀਂ ਦੇ ਸਕਦਾ ਉਹ ਬਹੁਤ ਆਰਾਮ ਨਾਲ ਆ ਕੇ ਲੈ ਸਕਦੇ ਨੇ ਜਿਵੇਂ ਕਿ ਬਹੁਤ ਮਦਦ ਕੀਤੀ ਜਾ ਰਹੀ ਹੈ ਕੋਵਿਡ ਮਹਾ ਕੋਵਿਡ ਮਹਾਂਮਾਰੀ ਦੌਰਾਨ ਹਸਪਤਾਲਾਂ ਨੇ ਬਹੁਤ ਮਦਦ ਕੀਤੀ ਕਿ ਜਿਵੇਂ ਕਿ ਮ ਮਰਨ ਵਾਲੀ ਕਗਾਰ